ਹਾਂ ਹੈਲੋ ਫਲਿੱਪਕਾਡ ਤੋਂ ਬੋਲਦੇ ਹਾਂ ਹਾਂ ਮੈਂ ਤਾਂ ਆਪਣੇ ਨਾ ਰਣਜੀਤ ਸਿੰਘ ਬੋਲਦਾ ਤੁਹਾਡੇ ਆਪਣੇ ਨੋਵਲ ਦਾ ਇੱਕ ਆਡਰ ਕੀਤਾ ਸੀਗਾ ਅਤੇ ਨਾਵਲ ਜੋ ਹੈ ਬਹੁਤ ਅੱਛਾ ਯਾਨੀ ਕਿ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਹੈ ਬੜੀ ਮੁਸ਼ਕਿਲ ਦੇ ਨਾਲ ਮਿਲਦਾ ਉਹ ਵੈਸੇ ਤਾਂ ਨਾਵਲ ਤੁਹਾਡਾ ਪਹੁੰਚ ਗਿਆ ਬੰਦਾ ਆਇਆ ਦੇਣ ਹੈ ਅਤੇ ਡਿਲੀਵਰੀ ਬਹੁਤ ਅੱਛੇ ਟਾਈਮ 'ਤੇ ਠੀਕ ਅਤੇ ਬਹੁਤ ਵਧੀਆ ਪੁਜ਼ੀਸ਼ਨ 'ਚ ਬੰਦੇ ਤੁਹਾਡੇ ਦਾ ਸੁਭਾਅ ਵੀ ਠੀਕ ਹੈ ਅਤੇ ਇਸ ਕਰਕੇ ਆਪ ਜੀ ਦਾ ਬਹੁਤ ਧੰਨਵਾਦ ਠੀਕ ਓਕੇ